ਮੇਰੇ ਕੋਲ ਬੁਣਾਈ ਸਿੱਖਣ ਲਈ ਇੱਕ ਕਿਤਾਬ ਹੈ ਉਹ ਤਾਂ ਮੈਨੂੰ ਸਿੱਖ ਸਿਲਾਈ ਕਢਾਈ ਅਤੇ ਬੁਣਾਈ ਮੇਰੇ ਦਾਦੀ ਜੀ ਵੱਲੋਂ ਸਿਖਾਈ ਗਈ ਸੀ ਜਿਹੜੀ ਕਿ ਪੀੜ੍ਹੀ ਦਰ ਪੀੜ੍ਹੀ ਅੱਗੇ ਵਧੀ ਹੈ ਹੁਣ ਮੈਂ ਆਪਣੇ ਬੱਚਿਆਂ ਅਤੇ ਨੂੰਹ ਨਾਲ਼ ਸਿਲਾਈ ਬੁਣਾਈ ਦਾ ਕੰਮ ਕਰਦੀ ਹਾਂ ਆਸ ਪਾਸ ਦੀਆਂ ਗੁਆਂਢਣਾਂ ਵੀ ਮੈਨੂੰ ਕੰਮ ਪੁੱਛਣ ਆਉਂਦੀਆਂ ਹਨ ਮੇਰਾ ਇੱਕ ਸ਼ੋਸ਼ਲ ਮੀਡੀਆ ਯੂਟਿਊਬ ਉੱਤੇ ਖਾਤਾ ਹੈ ਜਿਸ ਵਿੱਚ ਮੈਂ ਆਪਣੀ ਸਿਲਾਈ ਕਢਾਈ ਦੀਆਂ ਵੀਡੀਓ ਬਣਾ ਕੇ ਪਾਉਂਦੀ ਹਾਂ